ਮੈਨੂੰ ਸ਼ੁਰੂ ਤੋਂ ਹੀ ਮੋਟਰਸਾਈਕਲ ਚਲਾਉਣ ਦਾ ਸ਼ੌਂਕ ਰਿਹਾ ਹੈ ਇਸ ਲਈ ਮੈਂ ਚੌਦਾਂ ਸਾਲ ਦੀ ਉਮਰ ਵਿੱਚ ਹੀ ਮੋਟਰਸਾਈਕਲ ਚਲਾਉਣਾ ਸਿੱਖ ਲਿਆ ਜਦੋਂ ਮੇਰੀ ਉਮਰ ਉੱਨੀ ਸਾਲ ਹੋਈ ਮੈਂ ਆਪਣਾ ਲਾਈਸੈਂਸ ਅਪਲਾਈ ਕਰ ਦਿੱਤਾ ਮੇਰੇ ਜਨਮਦਿਨ 'ਤੇ ਮੇਰੇ ਵੱਡੇ ਭਰਾ ਨੇ ਮੈਨੂੰ ਇੱਕ ਮੋਟਰਸਾਈਕਲ ਤੋਹਫੇ ਵਜੋਂ ਦਿੱਤੀ ਉਦੋਂ ਤੋਂ ਹੀ ਮੈਂ ਲੰਬੀ ਬਾਈਕਿੰਗ ਸ਼ੁਰੂ ਕਰ ਦਿੱਤੀ ਕਿਉਂਕਿ ਮੈਨੂੰ ਘੁੰਮਣਾ ਬਹੁਤ ਪਸੰਦ ਹੈ ਅੱਜ ਮੈਂ ਬਠਿੰਡਾ ਤੋਂ ਹਿਮਾਚਲ ਪ੍ਰਦੇਸ਼ ਲੰਬੀ ਬਾਈਕਿੰਗ ਯਾਤਰਾ ਲਈ ਜਾ ਰਿਹਾ ਹਾਂ ਮੈਂ ਰਸਤੇ ਵਿੱਚ ਕਿੱਥੇ ਕਿੱਥੇ ਰੁਕਣਾ ਹੈ ਸਾਰਾ ਕੁਝ ਮਿਥ ਲਿਆ ਹੈ ਮੈਂ ਆਪਣੇ ਨਾਲ ਇੱਕ ਟੂਲ ਬਾਕਸ ਜਿਸ ਵਿੱਚ ਪੈਂਚਰ ਲਗਾਉਣ ਦਾ ਸਮਾਨ ਜਾਂ ਹੋਰ ਬਾਈਕ ਰਪੇਰਿੰਗ ਦਾ ਛੋਟਾ ਮੋਟਾ ਸਮਾਨ ਹੈ ਜੇ ਤੁਸੀਂ ਕਦੇ ਵੀ ਕਿਸੇ ਲੰਬੀ ਯਾਤਰਾ 'ਤੇ ਨਿੱਜੀਵਾਨ ਜਾ ਰਹੇ ਹੋ ਤਾਂ ਤੁਹਾਡੇ ਕੋਲ ਤੁਹਾਡੇ ਵਾਹਨ ਨੂੰ ਠੀਕ ਕਰਨ ਦਾ ਥੋੜ੍ਹਾ ਬਹੁਤ ਸਮਾਨ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਮੈਂ ਆਪਣੇ ਖਾਣ ਲਈ ਸੁੱਕਾ ਖਾਣਾ ਜਿਵੇਂ ਬਿਸਕਿਟ ਮੇਵੇ ਆਦਿ ਰੱਖ ਲਏ ਹਨ